ਪਾਣੀ ਸਾਡੀ ਜ਼ਿੰਦਗੀ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੈ ਇਹ ਸਾਡੇ ਸਰੀਰ ਦੀ ਵੱਧ ਤੋਂ ਵੱਧ ਕੰਮਕਾਜੀ ਕਾਰਵਾਈਆਂ ਵਿੱਚ ਭੂਮਿਕਾ ਨਿਭਾਉਂਦਾ ਹੈ ਜਿਵੇਂ ਕਿ ਹਜ਼ਮ ਪ੍ਰਕਿਰਿਆ ਤਾਪਮਾਨ ਸੰਤੁਲਨ ਅਤੇ ਊਰਜਾ ਉਤਪੱਤੀ ਵੈਸੇ ਤਾਂ ਸਾਡਾ ਸਰੀਰ ਸੱਠ ਤੋਂ ਸੱਤਰ ਪ੍ਰਤੀਸ਼ਤ ਤੱਕ ਪਾਣੀ ਤੋਂ ਬਣਿਆ ਹੁੰਦਾ ਹੈ ਇਸ ਕਰਕੇ ਇਹ ਜ਼ਰੂਰੀ ਹੈ ਕਿ ਅਸੀਂ ਦਿਨ ਦੇ ਦੌਰਾਨ ਵਧੀਆ ਹਾਈਡਰੇਸ਼ਨ ਬਣਾਈ ਰੱਖੀਏ ਸਾਡੀ ਦਿਨ ਚੜੀ ਅਤੇ ਸਰੀਰਿਕ ਲੋੜਾਂ ਦੇ ਆਧਾਰ 'ਤੇ ਹੀ ਹੀ ਸਾਨੂੰ ਪਾਣੀ ਦੀ ਸਹੀ ਮਾਤਰਾ ਲੈਣੀ ਚਾਹੀਦੀ ਹੈ ਜਿਸ ਕਰਕੇ ਅਸੀਂ ਚੁਸਤ ਅਤੇ ਤੰਦਰੁਸਤ ਰਹਾਂਗੇ ਦਿਨ ਵਿੱਚ ਪਾਣੀ ਦੀ ਲੋੜ ਕਿਸ ਤਿੰਨ ਚੀਜ਼ਾਂ 'ਤੇ ਨਿਰਭਰ ਕਰਦੀ ਹੈ ਸਭ ਤੋਂ ਪਹਿਲੀ ਚੀਜ਼ ਜੋ ਹੈ ਕਿ ਸਰੀਰਿਕ ਸਰਗਰਮੀਆਂ ਜੇਕਰ ਕੋਈ ਵਿਅਕਤੀ ਵੱਧ ਮਿਹਨਤ ਵਾਲੇ ਕੰਮ ਕਰਦਾ ਹੈ ਜਾਂ ਵਿਆਮ ਕਰਦਾ ਹੈ ਤਾਂ ਉਸਨੂੰ ਹੋਰ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ ਦੂਸਰੀ ਚੀਜ਼ ਮੌਸਮ ਗਰਮੀ ਦੇ ਮੌਸਮ ਵਿੱਚ ਸਰੀਰ ਵੱਧ ਪਸੀਨਾ ਛੱਡਦਾ ਹੈ ਜਿਸ ਕਰਕੇ ਸਾਨੂੰ ਪਾਣੀ ਦੀ ਲੋੜ ਸਰਦੀਆਂ ਨਾਲੋਂ ਗਰਮੀਆਂ ਵਿੱਚ ਜ਼ਿਆਦੀ ਚਾਹੀਦੀ ਹੈ ਤੀਸਰੀ ਚੀਜ਼ ਸਿਹਤ ਦੀ ਸਥਿਤੀ ਜੇਕਰ ਕਿਸੇ ਨੂੰ ਕੋਈ ਬਿਮਾਰੀ ਹੈ ਜਿਵੇਂ ਕਿ ਬੁਖਾਰ ਤਾਂ ਡਾਕਟਰ ਵੱਲੋਂ ਵਧੇਰੇ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਸਾਨੂੰ ਆਪਣੇ ਪਾਣੀ ਦੀ ਲੋੜ ਆਪਣੇ ਅਨੁਸਾਰ ਹੀ ਰੱਖਣੀ ਚਾਹੀਦੀ ਹੈ